ਬਿਮਾਰੀਆਂ ਤੋਂ ਬਚਣ ਲਈ ਅਤੇ ਸਿਹਤਮੰਦ ਰਹਿਣ ਲਈ ਕੁਛ ਛੋਟੀਆਂ ਛੋਟੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਕਿ ਸੁਧਾਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਸਾਨੂੰ ਫਾਸਟ ਫੂਡ ਜੰਕ ਫੂਡ ਨਹੀਂ ਖਾਣਾ ਚਾਹੀਦਾ ਜ਼ਿਆਦਾਤਰ ਘਰ ਦਾ ਖਾਣਾ ਖਾਣਾ ਚਾਹੀਦਾ ਅਤੇ ਖਾਣੇ ਵਿੱਚ ਬਹੁਤਾ ਸਪਾਈਸੀ ਅਤੇ ਮਸਾਲੇਦਾਰ ਚੀਜ਼ਾਂ ਨਹੀਂ ਯੂਸ ਕਰਨੀਆਂ ਚਾਹੀਦੀਆਂ ਇਸ ਤੋਂ ਇਲਾਵਾ ਸਾਨੂੰ ਹੈਂਡ ਵਾਸ਼ ਕਰਨ ਤੋਂ ਬਿਨਾਂ ਕੁਛ ਵੀ ਖਾਣਾ ਨਹੀਂ ਚਾਹੀਦਾ ਬਾਹਰ ਦਾ ਖਾਣਾ ਅਵੋਆਈਡ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਸਾਨੂੰ ਵਾਇਰਲ ਦੇ ਹੋਣ ਦੇ ਚਾਂਸਿਸ ਦੇ ਵਿੱਚ ਮਾਕਸ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਮੌਸਮ ਚੇਂਜ ਹੋਣ 'ਤੇ ਮੋਸਕੀਟੋਸਸ ਕਰੀਮ ਵਗੈਰਾ ਲਗਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਮੱਛਰਾਂ ਤੋਂ ਬਚਾਅ ਸਕੀਏ ਜੇ ਅਸੀਂ ਸਥਾਨਕ ਤੌਰ 'ਤੇ ਗੱਲ ਕਰੀਏ ਤਾਂ ਅਸੀਂ ਸੁਧਾਰ ਕਰਨੇ ਚਾਹੀਦੇ ਸਾਨੂੰ ਆਪਣੇ ਘਰ ਦੀ ਸਾਫ ਸਫਾਈ ਆਪਣੇ ਆਲੇ ਦੁਆਲੇ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਆਲੇ ਦੁਆਲੇ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ ਅਤੇ ਫੁੱਲਾਂ ਦਾ ਪਾਣੀ ਰਿਮੂਵ ਕਰ ਦੇਣਾ ਚਾਹੀਦਾ ਹੈ ਡੇਂਗੂ ਦੇ ਸੀਜ਼ਨ ਦੇ ਵਿੱਚ ਅਤੇ ਟੈਂਕੀਆਂ ਦੀ ਪਰੋਪਰ ਸਫਾਈ ਹੋਣੀ ਚਾਹੀਦੀ ਹੈ ਸਾਫ਼ ਸੁਥਰਾ ਪਾਣੀ ਪੀਣਾ ਚਾਹੀਦਾ ਹੈ ਯੋਗਾ ਮੈਡੀਟੇਸ਼ਨ ਵਗੈਰਾ ਜ਼ਰੂਰ ਕਰਨੀ ਚਾਹੀਦੀ ਹੈ ਹਲਕੀ ਵੋਕ ਅਤੇ ਹਲਕੀ ਐਕਸਰਸਾਈਜ਼ ਸਰੀਰ ਲਈ ਬਹੁਤ ਜ਼ਰੂਰੀ ਹੈ